ਮੈਂ ਘਰ ਫੁੱਲ ਬੂਟੇ ਵੀ ਬਹੁਤ ਲਾਇਆ ਬਾਗਵਾਨ ਦਾ ਮੈਨੂੰ ਹਰੇ ਬਾਈ ਦਾ ਬਹੁਤ ਸ਼ੌਕ ਹੈ ਮੇਰੇ ਘਰ ਫੁੱਲ ਵੀ ਲੱਗੇ ਹੋਏ ਮੇਰੇ ਘਰ ਕੱਚੀ ਜਗ੍ਹਾ 'ਚ ਮੈਂ ਜ਼ਿਆਦਾ ਕਿ ਜਿਵੇਂ ਕਿ ਸਬਜ਼ੀਆਂ ਜ਼ਿਆਦਾ ਪਸੰਦ ਕਰਦੀ ਹਾਂ ਜਿਵੇਂ ਕਿ ਸ਼ਿਮਲਾ ਮਿਰਚ ਬੈਂਗਣੀ ਤੋਰੀ ਇਹਨਾਂ ਚੀਜ਼ਾਂ ਨੂੰ ਮੈਂ ਯੂਜ ਕਰਦੀ ਜਿਵੇਂ ਕਿ ਆਪਾਂ ਬੂਟਾ ਲਾ ਲੈਂਦੇ ਹਾਂ ਬੈਂਗਣੀ ਅਤੇ ਵੀ ਬੈਂਗਣੀ ਵੀ ਲੱਗ ਜਾਂਦੀ ਹੈ ਜਿਹੜੇ ਬਜ਼ਾਰ ਦੀਆਂ ਜੋ ਸਬਜ਼ੀਆਂ ਹੁੰਦੀਆਂ ਹੈਗੀਆਂ ਉਹ ਰੇਹ ਸਪਰੇਅ ਟੀਕਿਆਂ ਨਾਲ ਪਕਾਈਆਂ ਹੁੰਦੀਆ ਹੈਗੀਆਂ ਅਤੇ ਉਹ ਖਾਣ ਦੇ ਵਿੱਚ ਵੀ ਇੰਨਾ ਕੋਈ ਟੇਸਟ ਨਹੀਂ ਹੁੰਦਾ ਅਤੇ ਨਾ ਹੀ ਇੰਨਾ ਕੁ ਜ਼ਿਆਦਾ ਵਧੀਆ ਬਣਦੀਆਂ ਹੈ ਜਿਹੜੀਆਂ ਘਰ ਸਬਜ਼ੀਆਂ ਬਣਾਈਆਂ ਹੁੰਦੀਆਂ ਨੇ ਉਹਨਾਂ ਦਾ ਟੇਸਟ ਵੀ ਬਹੁਤ ਵਧੀਆ ਹੁੰਦਾ ਅਤੇ ਬਾਕੀ ਤਾਜ਼ੀਆਂ ਹੁੰਦੀਆਂ ਨੇ ਜਿਵੇਂ ਕਿ ਆਪਾਂ ਬੈਂਗਣੀ ਲਓ ਬੈਂਗਣੀ ਇੱਕ ਬੂਟੇ ਤੋਂ ਹੀ ਪੂਰੀ ਵੀ ਇੱਕ ਡੰਗ ਦੀ ਸਬਜ਼ੀ ਬਣ ਸਕਦੀ ਹੈ ਜੇ ਕਿਤੇ ਆਪਾਂ ਸ਼ਿਮਲਾ ਮਿਰਚ ਲਈਏ ਸ਼ਿਮਲਾ ਮਿਰਚ ਅਤੇ ਵੀ ਜੋ ਜੋ ਆਪਾਂ ਬੂਟੇ ਲਗਾਉਂਦੇ ਹਾਂ ਉਹਦੇ ਕੋਈ ਪੰਜ ਸੱਤ ਵੀ ਲੱਗ ਵੀ ਸਕਦੇ ਹੈ ਲਾਉਣ ਨਾਲ ਆਪਣੀ ਇੱਕ ਡੰਗ ਸਬਜ਼ੀ ਬਣਦੀ ਹੈ ਅਤੇ ਮੈਨੂੰ ਹਰਿਆਲੀ ਦਾ ਬਹੁਤ ਸ਼ੌਕ ਹੈ ਮੈਂ ਬਹੁਤ ਹੀ ਪਸੰਦ ਕਰਦੀ ਹਾਂ ਕਿ ਘਰ ਦੀਆਂ ਸਬਜ਼ੀਆਂ ਜੋ ਕਿ ਜਿਵੇਂ ਹੈ ਵੀ ਮੈਂ ਸਾਰੀਆਂ ਹੀ ਸਬਜ਼ੀਆਂ ਨੂੰ ਬਹੁਤ ਪਸੰਦ ਕਰਦੀ ਹਾਂ ਘਰ ਬਣਾਈਆਂ ਸਬਜ਼ੀਆਂ ਦਾ ਟੇਸਟ ਬਹੁਤ ਹੀ ਵਧੀਆ ਬਣਦਾ ਹੈ ਸਦਾ ਹੀ ਮੈਂ ਘਰ ਫੁੱਲ ਬੂਟੇ ਸਬਜ਼ੀਆਂ ਲਾ ਕੇ ਲਾਭ ਬਹੁਤ ਹੀ ਪਸੰਦ ਕਰਦੀ ਹਾਂ ਮੈਂ ਇਸ ਘਰ ਮਾ ਵੀ ਘਰ ਸਬਜ਼ੀਆਂ ਹੀ ਲਾਉਂਦੀ ਹਾਂ ਅਤੇ ਸਬਜ਼ੀਆਂ ਦਾ ਟੇਸਟ ਬਹੁਤ ਵਧੀਆ ਹੀ ਹੁੰਦੇ ਹੈਗੇ ਬਾਗ ਦੀ ਜਦੋਂ ਜੋ ਬਲੈਰੀ ਸਬਜ਼ੀ ਹੁੰਦੀ ਹੈ ਵੀ ਉਹਦਾ ਟੇਸਟ ਇੰਨਾ ਵਧੀਆ ਨਹੀਂ ਹੁੰਦਾ ਜਿੰਨਾ ਕਿ ਘਰ ਦੀਆਂ ਸਬਜ਼ੀਆਂ ਘਰ ਲਾਈਆਂ ਸਬਜ਼ੀਆਂ ਦਾ ਟੇਸਟ ਵਧੀਆ ਹੁੰਦਾ ਹੈ